ਹੈਲੋ ਮੀਸ਼ੋ ਕਸਟਮਰ ਕੇਅਰ ਮੈਂ ਤੁਹਾਡੀ ਸਾਈਟ 'ਤੇ ਵਿਆਹ ਲਈ ਏਅਰਿੰਗਸ ਆਰਡਰ ਕੀਤੇ ਸੀ ਪਹਿਲੀ ਗੱਲ ਜਿਸ ਦਿਨ ਦੇ ਆਰਡਰ ਰਿਸੀਵ ਹੋਣਾ ਸੀ ਉਸ ਦਿਨ ਤੋਂ ਕਾਫੀ ਲੇਟ ਹੋ ਗਿਆ ਸੀ ਐਂਡ 'ਤੇ ਜਿਹੜਾ ਆਰਡਰ ਸੀ ਏਅਰਿੰਗਸ ਦਾ ਬਹੁਤ ਹੀ ਜ਼ਿਆਦਾ ਹੈਵੀ ਸੀ ਐਂਡ ਉਸਦੇ ਮੋਤੀ ਵੀ ਬਹੁਤ ਟੁੱਟੇ ਹੋਏ ਸੀ ਜੋ ਇਸ ਵਿੱਚ ਧਾਗੇ ਦਾ ਕੰਮ ਕੀਤਾ ਹੋਇਆ ਸੀ ਉਹ ਵੀ ਬਹੁਤ ਟੁੱਟਿਆ ਹੋਇਆ ਸੀ ਇਹ ਬਹੁਤ ਹੀ ਬੈਡ ਤਰੀਕੇ ਨਾਲ ਪੈਕ ਕੀਤੇ ਹੋਏ ਸੀ ਉਹ ਗੱਤੇ ਦੇ ਡੱਬੇ ਵਿੱਚੋਂ ਪੈਕ ਕੀਤੇ ਹੋਏ ਸੀ ਅਤੇ ਡੱਬਾ ਵੀ ਪੂਰਾ ਟੁੱਟਿਆ ਹੋਇਆ ਸੀ ਜਿਸ ਤਰ੍ਹਾਂ ਕਿਸੇ ਭਾਰੀ ਚੀਜ਼ ਦਾ ਵਜ਼ਨ ਆਉਣ ਕਰਕੇ ਪੂਰਾ ਡੱਬਾ ਟੁੱਟ ਗਿਆ ਹੋਵੇ ਇਹ ਅਤੇ ਬਹੁਤ ਹੀ ਇਹ ਬੁਰੇ ਤਰੀਕੇ ਨਾਲ ਏਅਰਰਿੰਗਜ ਟੁੱਟ ਰਹੇ ਸੀ ਬਹੁਤ ਹੀ ਜ਼ਿਆਦਾ ਹੈਵੀ ਸੀ ਮੇ ਜਿਸ ਨਾਲ ਮੇਰੇ ਕੰਨ ਵੀ ਦੁਖ ਰਹੇ ਸੀ ਜਦਕਿ ਮੈਂ ਆਰਡਰ ਬਹੁਤ ਹੀ ਹਲਕੇ ਏਅਰਰਿੰਗਸ ਕੀਤੇ ਸੀ ਇਸ ਲਈ ਮੈਂ ਆਪਣੇ ਪੈਸੇ ਵਾਪਸ ਕਰਾਉਣਾ ਚਾਹੁੰਦੀ ਹਾਂ ਜਾਂ ਤਾਂ ਮੈਨੂੰ ਹੋਰ ਨਿਊ ਏਅਰਿੰਗਸ ਭੇਜੇ ਜਾਣ ਜਾਂ ਫਿਰ ਮੇਰੇ ਪੈਸੇ ਵਾਪਸ ਕੀਤੇ ਜਾਣ